ਹਾਂਜੀ ਕੌਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਰਚਰਨ ਸਿੰਘ ਬੋਲਦਾ ਜੀ ਅੱਛਾ ਜੀ ਅੱਛਾ ਵੀਰ ਜੀ ਹਾਂਜੀ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਹਾਂਜੀ ਹਾਂ ਪਛਾਣ ਲਿਆ ਜੀ ਹੋਰ ਠੀਕ ਠਾਕ ਹੋ ਠੀਕ ਹੈ ਜੀ ਹੋਰ ਅੱਛਾ ਜੀ ਅੱਛਾ ਇੱਥੇ ਦੱਸੋ ਜੀ ਦੱਸੋ ਜੀ ਅੱਛਾ ਜੀ ਅੱਛਾ ਜੀ ਹਾਂ ਜੀ ਹਾਂ ਦੁੱਧ ਦੱਧ ਅੱਜ ਕੱਲ੍ਹ ਵਧੀਆ ਨਹੀਂ ਮਿਲਦੇ ਹੈਗੇ ਆਪਣੇ ਕੋਲ ਹੈਗਾ ਜੀ ਆਪਣੇ ਕੋਲ ਦੁੱਧ ਵਾਲਾ ਬੰਦਾ ਅਤੇ ਆਪਣੇ ਇੱਕ ਇੱਥੇ ਹਾਂਜੀ ਹਾਂ ਆਪਣੇ ਨਾ ਇੱਥੇ ਇੱਕ ਸ਼ਰਮਾ ਡੇਅਰੀ ਹੈ ਜੀ ਅਤੇ ਹਾਂਜੀ ਉਹਨਾਂ ਕੋਲ ਦੁੱਧ ਦੱਧ ਬਹੁਤ ਵਧੀਆ ਹੁੰਦਾ ਜੀ ਆਪਾਂ ਮਤਲਬ ਕਈ ਸਾਲਾਂ ਤੋਂ ਉਹਨਾਂ ਤੋਂ ਹੀ ਲੈ ਰਹੇ ਹਾਂ ਜੀ ਦੁੱਧ ਵਗੈਰਾ ਅਤੇ ਬਹੁਤ ਵਧੀਆ ਦੁੱਧ ਦਿੰਦੇ ਆ ਆਪਾਂ ਨੂੰ ਚੰਗੀ ਫੈਟ ਹੁੰਦੀ ਹੈ ਮਤਲਬ ਉਹਦੇ ਵਿੱਚ ਅਤੇ ਹਾਂਜੀ ਹਾਂ ਆਪਾਂ ਮਤਲਬ ਜਾਣ ਕੇ ਸਾਰੇ ਆਪਣੇ ਆਲੇ ਦੁਆਲੇ ਵਾਲੇ ਗੁਆਂਢੀ ਆਂਢੀ ਗੁਆਂਢੀ ਸਾਰੇ ਆਪਾਂ ਉੱਥੋਂ ਹੀ ਲੈਂਦੇ ਹਾਂ ਜੀ ਦੁੱਧ ਆਪਾਂ ਅਤੇ ਬਹੁਤ ਵਧੀਆ ਦੁੱਧ ਹਾਂ ਰੇਟ ਮਤਲਬ ਉਹ ਦਿੰਦੇ ਆ ਜੀ ਆਹ ਸੱਤਰ ਕੁ ਰੁਪਏ ਲੀਟਰ ਦਿੰਦੇ ਨੇ ਜੀ ਉਹ ਮੱਝ ਦਾ ਦੁੱਧ ਹੈਗਾ ਜੀ ਹਾਂ ਬਹੁਤ ਵਧੀਆ ਦੁੱਧ ਆ ਜੇਕਰ ਤੁਸੀਂ ਗਾਂ ਦਾ ਦੁੱਧ ਵੀ ਲੈਣਾ ਚਾਹੋ ਤਾਂ ਉਹ ਵੀ ਮਿਲ ਜਾਂਦਾ ਜੀ ਉੱਥੋਂ ਅਤੇ ਹਾਂਜੀ ਹਾਂ ਉੱਥੇ ਮਤਲਬ ਦਹੀਂ ਵਗੈਰਾ ਮੱਖਣ ਵਗੈਰਾ ਪਨੀਰ ਲੈਣਾ ਤੁਸੀਂ ਜੇਕਰ ਤੁਸੀਂ ਖੋ ਖੋ ਖੋ ਖੋਆ ਵਗੈਰਾ ਲੈਣਾ ਮਤਲਬ ਬਹੁਤ ਇੱਕ ਨੰਬਰ ਚੀਜ਼ ਮਿਲੂ ਤੁਹਾਡੇ ਤੁਹਾਨੂੰ ਅਤੇ ਪਿਓਰਟੀ ਮਿਲੂ ਜੀ ਸੌ ਪਰਸੈਂਟ ਅਤੇ ਹਾਂਜੀ ਹਾਂ ਅਤੇ ਉਹਨਾਂ ਦਾ ਮਤਲਬ ਉਹ ਵੀ ਦਿੱਤਾ ਹੋਇਆ ਜੀ ਅਸੀਂ ਮਤਲਬ ਅਸੀਂ ਬਹੁਤ ਸਾਲਾਂ ਤੋਂ ਮਤਲਬ ਦਸ ਪੰਦਰ੍ਹਾਂ ਸਾਲਾਂ ਤੋਂ ਅਸੀਂ ਉੱਥੋਂ ਹੀ ਲੈ ਰਹੇ ਹਾਂ ਜੀ ਦੁੱਧ ਵਗੈਰਾ ਮੈਂ ਇੱਕ ਨੰਬਰ ਇੱਕ ਪੈਸੇ ਦੀ ਵੀ ਸ਼ਿਕਾਇਤ ਨਹੀਂ ਹੋਈ ਆਪਾਂ ਨੂੰ ਕਦੇ ਅਤੇ ਬਾਕੀ ਉਹਨਾਂ ਦਾ ਚੈਲੇਂਜ ਆ ਜੀ ਮਤਲਬ ਜੇਕਰ ਕੋਈ ਉਹਨਾਂ ਦੇ ਦੁੱਧ ਦੇ ਵਿੱਚ ਕੋਈ ਮਿਲਾਵਟ ਸਾਬਤ ਕਰਦਾ ਹੈਗਾ ਤਾਂ ਉਹ ਲੱਖ ਰੁਪਇਆ ਇਨਾਮ ਦਿੰਦੇ ਆ ਬੰਦੇ ਨੂੰ ਜੇਕਰ ਉਹਨਾਂ ਦੀ ਕੋਈ ਹਾਂ ਜੀ ਪ੍ਰੋਡਕਟ ਕਿਸੇ ਵੀ ਪ੍ਰੋਡਕਟ ਦੇ ਵਿੱਚ ਉਹਨਾਂ ਦੇ ਕੋਈ ਮਿਲਾਵਟ ਅ ਪਰੂਵ ਕਰਦਾ ਗਾ ਜਾਂ ਖੋਏ ਦੇ ਵਿੱਚ ਜਾਂ ਪਨੀਰ ਦੇ ਵਿੱਚ ਜਾਂ ਦੁੱਧ ਦੇ ਵਿੱਚ ਜਾਂ ਮੱਖਣ ਦੇ ਵਿੱਚ ਹਾਂਜੀ ਹਾਂ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊ ਮਤਲਬ ਅਸੀਂ ਵੀ ਜੇਕਰ ਕੋਈ ਤਿਉਹਾਰ ਹੁੰਦਾ ਜਾਂ ਦਿਵਾਲੀ ਹੁੰਦੀ ਹੈ ਜਾਂ ਕੋਈ ਹੋਰ ਸਾਨੂੰ ਖੋਆ ਵਗੈਰਾ ਅਸੀਂ ਘਰ ਲੈ ਕੇ ਆਉਂਦੇ ਹਾਂ ਉਹਨਾਂ ਤੋਂ ਕਈ ਵਾਰ ਅਸੀਂ ਦੁੱਧ ਵਗੈਰਾ ਲੈ ਆਉਂਦੇ ਹੈਗੇ ਮਤਲਬ ਘਰ ਖੋਆ ਕੱਢ ਲਈਦਾ ਗਾ ਅਤੇ ਹਾਂਜੀ ਹਾਂ ਕੋਈ ਪ੍ਰੋਬਲਮ ਨਹੀਂ ਆਊਗੀ ਇੱਕ ਨੰਬਰ ਚੀਜ਼ ਮਿਲੇਗੀ ਘਿਓ ਲੈਣਾ ਗਾ ਮੱਝ ਦਾ ਘਿਓ ਲੈਣਾ ਗਾ ਜੀ ਉਹ ਵੀ ਤੁਹਾਨੂੰ ਬਹੁਤ ਵਧੀਆ ਨਾਲੇ ਰੇਟ ਵੀ ਉਹਨਾਂ ਦੇ ਵਾਜਬ ਨੇ ਗੇ ਹਾਂਜੀ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਹਾਂਜੀ ਘਿਓ ਲੈਣਾ ਤੁਸੀਂ ਮੱਖਣ ਲੈਣਾ ਪਨੀਰ ਲੈਣਾ ਹਰ ਇੱਕ ਚੀਜ਼ ਮਿਲੇਗੀ ਜੀ ਤੁਹਾਨੂੰ ਡੇਅਰੀ ਨਾਲ ਜਿਹੜੀ ਵੀ ਕੋਈ ਵੀ ਚੀਜ਼ ਸੰਬੰਧਿਤ ਹੈ ਹਾਂਜੀ ਡੇਅਰੀ ਪ੍ਰੋਡਕਟ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲੇਗਾ ਉੱਥੇ ਹਾਂਜੀ ਹਾਂ ਅੱਛਾ ਜੀ ਅੱਛਾ ਕੋਈ ਗੱਲ ਨਹੀਂ ਹਾਂ ਮੈਂ ਤੁਹਾਨੂੰ ਨਾਲ ਲੈ ਜੂੰਗਾ ਅਤੇ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦੂੰਗਾ ਮੈਂ ਹਾਂ ਜਾਣ ਪਛਾਣ ਕਰਵਾ ਦੂੰਗਾ ਗੱਲ ਕਰਵਾ ਦੂੰਗਾ ਅਤੇ ਤੁਸੀਂ ਉੱਥੋਂ ਤੁਸੀਂ ਲੈ ਸਕਦੇ ਹੋ ਬੇਝਿਜਕ ਲੈ ਸਕਦੇ ਹੋ ਤੁਸੀਂ ਅਤੇ ਮਤਲਬ ਹਾਂ ਜੀ ਹਾਂ ਵਿਸ਼ਵਾਸ ਵਾਲੇ ਬੰਦੇ ਨੇ ਬਹੁਤ ਵਧੀਆ ਬੰਦੇ ਨੇ ਗੇ ਹਾਂਜੀ ਹਾਂ ਓਕੇ ਜੀ ਓਕੇ ਕੋਈ ਗੱਲ ਨਹੀਂ ਵੀਰ ਜੀ ਓਕੇ